ਸਾਡੀ ਜ਼ਿੰਦਗੀ ਦੇ ਵਿੱਚ ਜੋ ਕੋਈ ਵੀ ਘਟਨਾ ਵਾਪਰਦੀ ਹੈ ਉਹ ਖ਼ਬਰ ਦਾ ਈ ਰੂਪ ਧਾਰ ਲੈਂਦੀ ਹੈ ਅਤੇ ਮੀਡੀਆ ਨੂੰ ਇਹ ਸਾਰੀਆਂ ਖ਼ਬਰਾਂ ਮਿਲ ਜਾਂਦੀਆਂ ਨੇ ਛਾਪਣ ਦੇ ਲਈ ਅਤੇ ਮੀਡੀਆ ਸਾਰੀਆਂ ਖਬਰਾਂ ਨੂੰ ਇਕੱਠੀਆਂ ਕਰਕੇ ਲੋਕਾਂ ਦੇ ਵਿੱਚ ਉਸ ਦਾ ਪ੍ਰਚਾਰ ਕਰਦਾ ਹੈ ਅਤੇ ਇਹ ਖਬਰਾਂ ਦੇ ਵਿੱਚ ਘਟਨਾਵਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜੋ ਕਿ ਮੀਡੀਆ ਤੋਂ ਨਿਊਜ਼ ਚੈਨਲਾਂ ਤੋਂ ਗੁਮਰਾਹ ਹਨ ਜਿਵੇਂ ਕਿ ਨਸ਼ਾ ਦਿਨ ਬ ਦਿਨ ਵਧਦਾ ਜਾ ਰਿਹਾ ਏ ਅਤੇ ਸਰਕਾਰਾਂ ਵੀ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਅਤੇ ਮੀਡੀਆ ਨੂੰ ਚਾਹੀਦਾ ਹੈ ਕਿ ਜੋ ਨਸ਼ੇ ਦੇ ਨਾਲ ਨੌਜਵਾਨ ਮਰ ਰਹੇ ਹਨ ਬੇਰੁਜ਼ਗਾਰੀ ਬਹੁਤ ਹੀ ਜ਼ਿਆਦਾ ਫੈਲ ਰਹੀ ਹੈ ਜਿਸ ਕਰਕੇ ਨੌਜਵਾਨ ਨਸ਼ੇ ਦੇ ਵੱਲ ਉਤਸ਼ਾਹਿਤ ਹੋ ਰਹੇ ਹਨ ਅਤੇ ਫਿਰ ਹੱਤਿਆਵਾਂ ਵੱਲ ਭੱਜ ਰਹੇ ਹਨ ਇਸ ਕਰਕੇ ਮੀਡੀਆ ਨੂੰ ਅਜਿ ਇਹੋ ਜਿਹੀਆਂ ਖਬਰਾਂ ਛਾਪ ਕੇ ਸਰਕਾਰ ਦਾ ਧਿਆਨ ਖਬਰਾਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ